ਮੈਂ ਰੋਜ਼ ਸਵੇਰੇ ਉੱਠ ਕੇ ਰਨਿੰਗ ਕਰਦਾ ਅਤੇ ਤਕਰੀਬਨ ਅੱਧਾ ਘੰਟਾ ਰੋਜ਼ ਰਨਿੰਗ ਕਰਦਾ ਅਤੇ ਮੈਂ ਕੁਛ ਨਾ ਕੁਛ ਮੁਕਾਮ 'ਤੇ ਆਪਣੇ ਪਹੁੰਚਣਾ ਚਾਹੁੰਦਾ ਅਤੇ ਮੈਂ ਨਾ ਪੁਲਿਸ ਅਫਸਰ ਬਣਨਾ ਚਾਹੁੰਦਾ ਅਤੇ ਉਹਦੇ ਲਈ ਮੈਂ ਬਹੁਤ ਤਿਆਰੀ ਕਰ ਰਿਹਾ ਸਵੇਰੇ ਉੱਠ ਕੇ ਰਨਿੰਗ ਕਰ ਰਿਹਾ ਅਤੇ ਹੋਰ ਵੀ ਐਕਸਰਸਾਈਜ਼ ਵਗੈਰਾ ਕਰ